ਹਾਂਜੀ ਸਤਿ ਸ਼੍ਰੀ ਅਕਾਲ ਮੈਡਮ ਮਨਦੀਪ ਬੋਲ ਰਹੇ ਹੋ ਹਾਂਜੀ ਹਾਂਜੀ ਕੀ ਹਾਲ ਚਾਲ ਨੇ ਮੈਂ ਮਨਪ੍ਰੀਤ ਬੋਲ ਰਹੀ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਤੁਹਾਡੇ ਨੇਬਰਸ ਹਾਂ ਹਾਂਜੀ ਬਹੁਤ ਵਧੀਆ ਤੁਸੀਂ ਸੁਣਾਓ ਵਧੀਆ ਰਹੀ ਸ਼ਿਫਟਿੰਗ ਤੁਹਾਡੀ ਅੱਛਾ ਜੀ ਹੋਰ ਘਰ ਪਰਿਵਾਰ ਸਭ ਠੀਕ ਠਾਕ ਬਹੁਤ ਵਧੀਆ ਜੀ ਬਹੁਤ ਵਧੀਆ ਅੱਛਾ ਜੀ ਕੋਈ ਗੱਲ ਨਹੀਂ ਹੁਣ ਤੁਸੀਂ ਆ ਗਏ ਹੋ ਲਾਗੇ ਪਤਾ ਲੱਗ ਜਾਏਗਾ ਹੌਲੀ ਹੌਲੀ ਹਾਂਜੀ ਹਾਂਜੀ ਹਾਂਜੀ ਹਾਂਜੀ ਜ਼ਰੂਰ ਸ਼ੋਪਿੰਗ ਕੀ ਕਰਨੀ ਸ਼ੋਪਿੰਗ ਦੇ ਵਿੱਚ ਤੁਸੀਂ ਅੱਛਾ ਸਵੈਟਰ ਫੈਂਸੀ ਟਾਈਪ ਚਾਹੀਦੇ ਕਿ ਨੋਰਮਲ ਚਾਹੀਦੇ ਤੁਹਾਨੂੰ ਅੱਛਾ ਜੀ ਇੱਥੇ ਲਾਗੇ ਮਾਰਕੀਟ ਹੈਗੀ ਜੈਮਲ ਸਿੰਘ ਦਾ ਕਟੜਾ ਉੱਥੇ ਬੜੀ ਫੈਂਸੀ ਚੀਜ਼ ਮਿਲਦੀ ਹੈ ਬਹੁਤ ਸਾਰੀ ਕੁਆਲਿਟੀ ਕੁਆਲਿਟੀ ਬੜੀ ਅੱਛੀ ਹੁੰਦੀ ਉਹਨਾਂ ਦੀ ਪਰ ਇਹ ਹੈ ਕਿ ਬਾਰਗਨਿੰਗ ਕਰਨੀ ਪੈਂਦੀ ਹੈ ਰੇਟ ਥੋੜ੍ਹੇ ਉਹਨਾਂ ਦੇ ਇੱਦਾਂ ਦੇ ਹੀ ਹੁੰਦੇ ਨੇ ਹਾਂਜੀ ਫੇਫਿਰ ਉਸ ਤੋਂ ਬਾਅਦ ਸ਼ਿਮਲਾ ਮਾਰਕੀਟ ਹੈਗੀ ਆ ਉੱਥੇ ਤੁਹਾਨੂੰ ਬੈਸਟ ਚੀਜ਼ ਮਿਲੇਗੀ ਕਟੜਾ ਜੈਮਲ ਸਿੰਘ ਤੋਂ ਵੀ ਲੈ ਲਈਦੇ ਹੈ ਸ਼ਿਮਲਾ ਮਾਰਕੀਟ ਤੋਂ ਵੀ ਲੈ ਲਈਦੇ ਹੈ ਲੋਕੇਸ਼ਨ ਦੇ ਅਕੋਰਡਿੰਗ ਕਿਹੋ ਜਿਹੇ ਆਪਾਂ ਵੇਅਰ ਕਰਨੇ ਹੋਣ ਉਸ ਅਕੋਡਿੰਗ ਲੈ ਲਈਦੇ ਹੈ ਵੈਸੇ ਇੱਥੇ ਚਾਟੀਵਿੰਡ ਗੇਟ 'ਤੇ ਰਾਮਗੜੀਆ ਮਾਰਕੀਟ ਹੈਗੀ ਆ ਉੱਥੇ ਵੀ ਕਾਫੀ ਸ਼ੋਪਸ ਨੇ ਉਹਨਾਂ 'ਤੇ ਵੀ ਅੱਛੇ ਵੈਸੇ ਮਿਲ ਜਾਂਦੇ ਨੇ ਨੋਰਮਲ ਟੂ ਹਾਈ ਰੇਂਜ ਜਿਸ ਤਰ੍ਹਾਂ ਦੇ ਚਾਹੋ ਤੁਸੀਂ ਵਰਾਈਟੀ ਵੀ ਕਾਫੀ ਮਿਲ ਜਾਂਦੀ ਹੈ ਬਾਕੀ ਪੁਤਲੀ ਘਰ ਮਾਰਕੀਟ ਉਹ ਤਾਂ ਹੈ ਹੀ ਆ ਉੱਥੇ ਵੀ ਕਾਫੀ ਵਰਾਇਟੀ ਹੁੰਦੀ ਹੈ ਬਰੈਂਡਡ ਲੈਣੇ ਹੋਣ ਤਾਂ ਫਿਰ ਤੁਹਾਨੂੰ ਮੌਲ ਜਾਣਾ ਪਏਗਾ ਅੰਮ੍ਰਿਤਸਰ ਅਲਫਾ ਵਨ ਮੋਲ ਹੈਗਾ ਹੈ ਉੱਥੇ ਤੁਹਾਨੂੰ ਬਰੈਂਡਡ ਹਰ ਤਰ੍ਹਾਂ ਦਾ ਬ੍ਰਾਂਡ ਉੱਥੇ ਤੁਹਾਨੂੰ ਮਿਲ ਜਾਏਗਾ ਹਾਂਜੀ ਹਾਂਜੀ ਜ਼ਰੂਰ ਕਦੋਂ ਜਾਣਾ ਹੈ ਜੀ ਚਲੋ ਠੀਕ ਹੈ ਮੈਂ ਤੁਹਾਨੂੰ ਫਰੀ ਹੋ ਕੇ ਅਤੇ ਤਾਂ ਫਿਰ ਬਣਾ ਲੈਂਦੇ ਪਲੈਨ ਅਤੇ ਫਿਰ ਜਾ ਕੇ ਲਿਆ ਨੇ ਠੀਕ ਹੈ ਜੀ ਓਕੇ ਜੀ ਥੈਂਕ ਯੂ ਜੀ ਓਕੇ ਓਕੇ